ਹੈਲੋ ਨਮਸਕਾਰ ਜੀ ਮੈਂ ਨਰੇਸ਼ ਕੁਮਾਰ ਬੋਲ ਰਿਹਾ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਇੱਥੇ ਜਿਹੜੇ ਵੀ ਸੈਲਾਨੀ ਵਗੈਰਾ ਆਉਂਦੇ ਨੇ ਔਰ ਇੱਥੇ ਮਲਕੀ ਆਰਾਮ ਨਾਲ ਰਹਿ ਸਕਦੇ ਨੇ ਸਹੂਲਤਾਂ ਪੂਰੀਆਂ ਮਿਲਣਗੀਆਂ ਪਠਾਨਕੋਟ ਦੇ ਵਿੱਚ ਪੂਰੀਆਂ ਸਹੂਲਤਾਂ ਹੈਗੀਆਂ ਇੱਥੇ ਧਰਮਸ਼ਾਲਾ ਵਗੈਰਾ ਹੈਗੀਆਂ ਆ ਗੁਰਦੁਆਰੇ ਕਾਫੀ ਗੁਰਦੁਆਰੇ ਹੈ ਜਿੱਥੇ ਰੋਟੀ ਪਾਣੀ ਖਾਣ ਨੂੰ ਮਿਲੇਗਾ ਉਹਨੂੰ ਰਹਿਣ ਦੀ ਪੂਰੀ ਬੰਦੋਬਸਤ ਹੈਗਾ ਹੈ ਧਰਮਸ਼ਾਲਾ ਵੀ ਇੱਦਾਂ ਦੀ ਹੈਗੀ ਕਿ ਰੋਟੀ ਪਾਣੀ ਸਭ ਕੁਛ ਮਿਲੇਗਾ ਉਹਨਾਂ ਨੂੰ ਜੇ ਉਹ ਹੋਟਲ ਵੀ ਲੈਣਾ ਚਾਹੁਣ ਤਾਂ ਹੋਟਲ ਵੀ ਮਤਲਬ ਕਿ ਬਿਲਕੁਲ ਸਸਤੇ ਰੇਟ 'ਤੇ ਅਤੇ ਵਧੀਆ ਕਮਰੇ ਸਭ ਕੁਛ ਵਧੀਆ ਰਹਿਣਾ ਸਹਿਣਾ ਨਹਾਉਣ ਪੀਣ ਦਾ ਸਭ ਕੁਝ ਵਧੀਆ ਸਮਾਨ ਮਿਲਦਾ ਹੈ ਮਲਕੀ ਕਿਸੇ ਚੀਜ਼ ਦੀ ਇੱਥੇ ਕਮੀ ਨਹੀ ਆਉਂਦੀ ਵਧੀਆ ਰਹਿਣ ਸਹਿਣ ਦਾ ਆਲ ਆਸ ਪਾਸ ਆਂਡ ਗੁਆਂਢ ਸਭ ਠ ਬਹੁਤ ਵਧੀਆ ਆ ਕੋਈ ਡਰ ਖਤਰਾ ਨਹੀਂ ਹੈ ਕੋਈ ਕੁਛ ਨਹੀਂ ਆਲ ਜ਼ਿਆਦਾ ਤਾਂ ਵੈਸੇ ਸਾਡੇ ਪਠਾਨਕੋਟ ਦੇ ਵਿੱਚ ਆਰਮੀ ਬਹੁਤ ਜ਼ਿਆਦਾ ਆ ਇੱਥੇ ਡਰ ਖਤਰੇ ਦੀ ਕੋਈ ਕਮੀ ਨਹੀਂ ਹੈ ਉਹ ਨਹੀ ਹੈ ਕਿ ਡਰ ਡਰ ਖਤਰਾ ਕੋਈ ਨਹੀ ਹੈ ਬੰਦਾ ਬੇਝਿਜਕ ਹੋ ਰਹਿ ਸਕਦਾ ਹੈ ਇੱਥੇ ਸਾਨੂੰ ਦੋ ਬਾਰਡਰ ਲੱਗਦੇ ਹੈ ਹਿਮਾਚਲ ਦਾ ਬਾਰਡਰ ਵੀ ਸਾਡੇ ਲਾਗੇ ਜੇ ਐਂਡ ਕੇ ਦਾ ਬਾਰਡਰ ਵੀ ਲਾਗੇ ਹੈ ਬਹੁਤ ਵਧੀਆ ਸਹੂਲਤਾਂ ਸਾਡੇ ਇੱਥੇ ਰਹਿਣ ਵਾਸਤੇ ਜਿੱਥੇ ਮਰਜ਼ੀ ਰਹਿ ਸਕਦੇ ਗੁਰਦੁਆਰੇ ਹੈ ਸਭ ਕੁਛ ਹੈਗਾ ਜੀ ਮੋਸਟ ਵੈਲਕਮ ਜਿਸ ਸੈਲਾਨੀ ਨੇ ਆਉਣਾ ਹੋਏ ਸਾਡੇ ਪਠਾਨਕੋਟ ਹੋ ਕੇ ਜ਼ਰੂਰ ਜਾਵੇ ਇੱਥੋਂ ਦੀ ਹਿਮਾਚਲ ਦਾ ਰਸਤਾ ਸ਼ੁਰੂ ਹੁੰਦਾ ਯਾਤਰਾ ਕੋਈ ਵੀ ਹਿਮਾਚਲ ਟੂਰਿਸਟ ਘੁੰਮਣ ਵਾਸਤੇ ਜਾਣਾ ਜੇ ਐਂਡ ਕੇ ਜਾਣਾ ਇੱਧਰੋਂ ਦੀ ਜਾ ਸਕਦਾ ਵਾ